ਇੱਕ ਕਲਾਕਾਰ ਮਤਲਬ ਕਹਿ ਦਓ ਕਿ ਡਰਾਇੰਗ ਦੇ ਵਿੱਚ ਹੋਣ ਦੇ ਨਾਤੇ ਸਾਨੂੰ ਮਤਲਬ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਇਸ ਤਰ੍ਹਾਂ ਹੁੰਦਾ ਚੁਣੌਤੀਆਂ ਇੱਦਾਂ ਆਉਂਦੀਆਂ ਨੇ ਕਿ ਸਾਡਾ ਮਨ ਨੂੰ ਕਰਦਾ ਆ ਕਿ ਅਸੀਂ ਕੁਝ ਸੀਨ ਦੇਖਦੇ ਹਾਂ ਉਹਨੂੰ ਅੱਛਾ ਡਰੋਅ ਕੀਤਾ ਜਾਵੇ ਬਟ ਮਤਲਬ ਕਹਿ ਦਓ ਕਿ ਸਾਡੀ ਕਲਾ ਇੰਨੀ ਬਹੁਤ ਹਾਇਰ ਉਹਦੀ ਨਹੀਂ ਹੈ ਕਿ ਸਾਨੂੰ ਚੁਣੌਤੀਆਂ ਕਈ ਵਾਰ ਆ ਜਾਂਦੀਆਂ ਨੇ ਕਿ ਹੂ ਬ ਹੂ ਅਸੀਂ ਕਿਸੇ ਵੀ ਪਿਕਚਰ ਨੂੰ ਦੇਖ ਕੇ ਜਾਂ ਕਿਸੇ ਵੀ ਕੁਦਰਤੀ ਸੋਮੇ ਨੂੰ ਦੇਖ ਕੇ ਅਸੀਂ ਉਵੇਂ ਨਹੀਂ ਬਣਾ ਸਕਦੇ ਠੀਕ ਹੈ ਅਤੇ ਕਮੀਆਂ ਕਿਵੇਂ ਆ ਜਾਂਦੀਆਂ ਨੇ ਕਈ ਵਾਰ ਮਨ ਮਤਲਬ ਜਿਵੇਂ ਆ ਹਾਈ ਲੈਵਲ ਦੀ ਮਤਲਬ ਡਰਾਇੰਗ ਕਰਨ 'ਤੇ ਜਾਂ ਮਤਲਬ ਕਹਿ ਦਓ ਕੋਈ ਪਿਕਚਰ ਵਗੈਰਾ ਬਣਾਉਣ 'ਤੇ ਠੀਕ ਹੈ ਕਈ ਵਾਰ ਜਿਵੇਂ ਘਰ ਵਿੱਚ ਛੋਟੇ ਬੱਚੇ ਹੁੰਦੇ ਨੇ ਉਹ ਖਰਾਬ ਕਰ ਦਿੰਦੇ ਨੇ ਜਾਂ ਮਤਲਬ ਉਹ ਆ ਕੇ ਆਪਣਾ ਹੀ ਵਿੱਚ ਸ਼ੁਰੂ ਹੋ ਜਾਂਦੇ ਨੇ ਮਤਲਬ ਇਹ ਡਰਾਇੰਗ ਕਰਨ ਦੇ ਲਈ ਉਹ ਚੁਣੌਤੀਆਂ ਦੂਰ ਕਰਨਾ ਜੇ ਹੋਵੇ ਤਾਂ ਬਹੁਤ ਇਕਾਂਤ ਜਗ੍ਹਾ ਚਾਹੀਦੀ ਆ ਬਹੁਤ ਮਤਲਬ ਫਰੀ ਮਾਇੰਡ ਹੋਣਾ ਚਾਹੀਦਾ ਤੁਹਾਡੇ ਮਨ ਦੇ ਵਿੱਚ ਮਤਲਬ ਕੀ ਆ ਰਿਹਾ ਵਾ ਜੋ ਤੁਹਾਡੇ ਮਨ ਦੇ ਪਿ ਵਿੱਚ ਪਿਚਰ ਆ ਰਹੀ ਹੈ ਤੁਸੀਂ ਉਹਨੂੰ ਹੀ ਉਤਾਰ ਕੇ ਬਣਾ ਸਕਦੇ ਹੋ ਠੀਕ ਹੈ ਚੁਣੌਤੀਆਂ ਕੋਈ ਖ਼ਾਸ ਨਹੀਂ ਆਉਂਦੀਆਂ ਇਹਦੇ ਵਿੱਚ ਚੁਣੌਤੀਆ ਘਰ ਦੇ ਮਾਹੌਲ ਵਿੱਚ ਨਹੀਂ ਬਣਾਇਆ ਜਾ ਸਕਦਾ ਕਿਸੇ ਵੀ ਆਰਟ ਨੂੰ ਜਾ ਕਿਸੇ ਵੀ ਕਲਾਕਾਰੀ ਨੂੰ ਇਹਦੇ ਲਈ ਕੁਛ ਸਮਾਂ ਇਕਾਂਤ ਜਾਂ ਮਤਲਬ ਕਹਿ ਦਓ ਇਹ ਇੱਦਾਂ ਦੀ ਜਗ੍ਹਾ ਚਾਹੀਦੀ ਹੈ ਜਿੱਥੇ ਤੁਸੀਂ ਔਰ ਤੁਹਾਡਾ ਆਰਟ ਹੋਵੇ ਬਸ